ਹੈਲੋ ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਭਾਜ ਭੈਣ ਜੀ ਮੈਂ ਠੀਕ ਹਾਂ ਤੁਸੀਂ ਦੱਸੋ ਤੁਹਾਨੂੰ ਪਤਾ ਕਿ ਅੱਜ ਕੱਲ੍ਹ ਖੇਤੀਬਾੜੀ ਦੇ ਮਾਮਲੇ 'ਚ ਪੰਜਾਬ ਨੇ ਕਿੰਨੀ ਚੜ੍ਹਾਈ ਕੀਤੀ ਹੈ ਅਤੇ ਜੀ ਜੀ ਜੀ ਜੀ ਸਾਨੂੰ ਵੀ ਪੰਜਾ ਕਿਸਾਨਾਂ ਦਾ ਸਹਿਯੋਗ ਕਰਨਾ ਚਾਹੀਦਾ ਇਹਦੇ ਮਾਮਲੇ 'ਚ ਅਤੇ ਸਾਨੂੰ ਵੀ ਸਿਰਫ ਔਰਗੈਨਿਕ ਚੀਜ਼ਾਂ ਹੀ ਲੈਣੀ ਚਾਹੀਦੀਆਂ ਜੀ ਜੀ ਅਤੇ ਸਾਨੂੰ ਵੀ ਵੱਧ ਤੋਂ ਵੱਧ ਸਬਜ਼ੀਆਂ ਖਰੀਦਣੀਆਂ ਚਾਹੀਦੀਆਂ ਹਨ ਤੇ ਅਤੇ ਸਾਨੂੰ ਸਿਰਫ ਔਰਗੈਨਿਕ ਹੀ ਹਾਂਜੀ ਚਲੋ ਠੀਕ ਹੈ ਭੈਣ ਜੀ